ਮੇਰਾ ਨਾਮ ਚਰਨਜੀਤ ਸਿੰਘ ਹੈਗਾ ਏ ਜਿੱਦਾਂ ਹੁਣ ਮਨ ਜਿੱਦਾਂ ਹੁਣ ਸਾਡੇ ਧਰਮ ਵਿੱਚ ਇੱਕ ਰੀਤ ਹੁੰਦੀ ਹੈਗੀ ਹੈ ਜਿੱਦਾਂ ਹੁਣ ਦੇਖੋ ਮਰਦ ਹੁੰਦਾ ਏ ਜਾਂ ਕੋਈ ਜਿਹੜਾ ਪੁਰਸ਼ ਹੈਗਾ ਏ ਉਹਦੇ ਆਪਣੇ ਨਾਮ ਪਿੱਛੇ ਉਹਨੂੰ ਸਿੰਘ ਲਾਉਣਾ ਅਤੇ ਜਿਹੜੀ ਔਰਤ ਆ ਉਹਨੂੰ ਆਪਣੇ ਨਾਂ ਪਿੱਛੇ ਕੌਰ ਲਾਣਾ ਕੰਪਲਸਰੀ ਹੁੰਦਾ ਹੈਗਾ ਏ ਇਹਦੇ ਨਾਲ ਕਿਆ ਹੁੰਦਾ ਹੈਗਾ ਜਿੱਦਾਂ ਹੁਣ ਮੰਨ ਲਉ ਸਾਡਾ ਸਿੱਖ ਧਰਮ ਹੈ ਇਹਦੇ ਬਾਰੇ ਜਿਹੜਾ ਸਕੂਲਾਂ ਵਿੱਚ ਹੈ ਉਹਦੇ ਵਿੱਚ ਸਕੂਲਾਂ ਵਿੱਚ ਸਾਨੂੰ ਜ਼ਿਆਦਾ ਡੀਪਲੀ ਨਹੀਂ ਪੜ੍ਹਾਇਆ ਜਾਂਦਾ ਹੈਗਾ ਏ ਜਿਹੜਾ ਜਿੱਦਾਂ ਹੁਣ ਮੰਨ ਲਉ ਸਾਡੇ ਸਿੱਖ ਧਰਮ ਦੇ ਦਸ ਗੁਰੂ ਹੋਏ ਹੈਗੇ ਹੈ ਅਤੇ ਗਿਆਰਵੇਂ ਸਾਡੇ ਦੇਹਧਾਰੀ ਗੁਰੂ ਨਹੀਂ ਹੈਗੇ ਹੈ ਉਹ ਗਿਆਰਵੇਂ ਗੁਰੂ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਏ ਹੈਗੇ ਆ ਉਹ ਸ਼ਬਦ ਗੁਰੂ ਹੈ ਜਿੱਦਾਂ ਹੁਣ ਮੰਨ ਲਉ ਜ ਜਿਹੜੇ ਸਾਡੇ ਸਕੂਲਾਂ ਵਿੱਚ ਹੈ ਸਕੂਲਾਂ ਵਿੱਚ ਜ਼ਿਆਦਾਤਰ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜ੍ਹਾਏ ਜਾਂਦਾ ਹੈਗਾ ਉਹ ਵੀ ਡੀਪਲੀ ਨਹੀਂ ਸਿਰਫ਼ ਉੱਪਰੋਂ ਉੱਪਰੋਂ ਦੀ ਪੜ੍ਹਾ ਤਾ ਜਾਂਦਾ ਹੈਗਾ ਏ ਨਾ ਤਾਂ ਉਹਨਾਂ ਦੀ ਸਿੱਖਿਆਵਾਂ ਬਾਰੇ ਦੱਸਿਆ ਜਾਂਦਾ ਏ ਉਹਨਾਂ ਨੇ ਕਿਹਾ ਕੁਛ ਦਸ ਕੀਤਾ ਹੈਗਾ ਹੈ ਕਿਆ ਕੁਛ ਸਾਨੂੰ ਕਰਨ ਲਈ ਆਖਿਆ ਹੈਗਾ ਉਹਨਾਂ ਬਾਰੇ ਨਾ ਸਾਨੂੰ ਡੀਪਲੀ ਪੜ੍ਹਾਇਆ ਜਾਂਦਾ ਹੈਗਾ ਏ ਅਤੇ ਜਿਹੜੇ ਜਿਹੜੇ ਬਾ ਇਹਨਾਂ ਤੋਂ ਦੋਨਾਂ ਗੁਰੂਆਂ ਤੋਂ ਇਲਾਵਾ ਜਿਹੜੇ ਬਾਕੀ ਦਾ ਬਾਕੀ ਅੱਠ ਗੁਰੂ ਹੋਏ ਹੈਗੇ ਹੈ ਉਹਨਾਂ ਬਾਰੇ ਤਾਂ ਸਾਨੂੰ ਪੜ੍ਹਾਇਆ ਹੀ ਨਹੀਂ ਜਾਂਦਾ ਹੈਗਾ ਹੈ ਹੁਣ ਜਿੱਦਾਂ ਹੁਣ ਮੰਨ ਲਉ ਦੇਖਿਆ ਜਾਵੇ ਤਾਂ ਜਿਹੜੇ ਵੀ ਜਿੱਦਾਂ ਹੁਣ ਜਿਹੜੇ ਵੀ ਕੋਈ ਪਾਠ ਪੁਸਤਕਾਂ ਹੈਗੀਆਂ ਏ ਉਹਨਾਂ ਵਿੱਚ ਜਿਹੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੈ ਉਹਨਾਂ ਨੂੰ ਸਿਰਫ਼ ਔਰ ਸਿਰਫ਼ ਇੱਕ ਲੜਾਕੂ ਯੋਧਾ ਦੱਸਿਆ ਗਿਆ ਹੈਗਾ ਏ ਉਹਨਾਂ ਬਾਰੇ ਨਾ ਤਾਂ ਕੋਈ ਹੋਰ ਕੁਛ ਦੱਸਿਆ ਜਾਂਦਾ ਹੈਗਾ ਏ ਵੀ ਉਹਨਾਂ ਨੇ ਕਿਆ ਕੁਛ ਕੀਤਾ ਹੈਗਾ ਏ ਉਹਨਾਂ ਨੇ ਕਿਆ ਕੁਛ ਸਿਹਾ ਹੈਗਾ ਏ ਉਹਨਾਂ ਨੂੰ ਉਹਨਾਂ ਨੇ ਮਤਲਬ ਧਰਮ ਦੀ ਖਾਤਰ ਆਪਣੇ ਪਿਤਾ ਨੂੰ ਜਦ ਕਹਿੰਦੇ ਸੀਗੇ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀਗਾ ਜਦੋਂ ਹਿੰਦੂ ਪੰਡਤ ਉਹਨਾਂ ਕੋਲ ਆਏ ਸੀਗੇ ਬੇ ਬੇ ਹੁਣ ਬੀ ਧਰਮ ਬਚਾਉਣ ਖਾਤਰ ਉਹਨਾਂ ਨੂੰ ਔਰੰਗਜ਼ੇਬ ਉੱਥੇ ਜ਼ਬਰਦਸਤੀ ਮੁਸਲਿਮ ਬਣਾ ਰਿਹਾ ਸੀਗਾ ਤਾਂ ਉਹਨਾਂ ਨੇ ਕਿਹਾ ਸੀਗਾ ਬਾਈ ਬੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਵੀ ਤੁਹਾਡੇ ਧਰਮ ਬਚਾਉਣ ਖਾਤਰ ਇੱਕ ਮਹਾਨ ਪੁਰਖ ਨੂੰ ਕੁਰਬਾਨੀ ਦੇਣੀ ਪਵੇਗੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਪਿਤਾ ਜੀ ਤੁਹਾਡੇ ਤੋਂ ਮਹਾਨ ਕੌਣ ਹੋ ਸਕਦਾ ਹੈ ਉਹਨਾਂ ਨੇ ਆਪਣੇ ਆਪਣੇ ਪਿਤਾ ਜੀ ਨੂੰ ਕੁਰਬਾਨੀ ਦੇਣ ਲਈ ਪ੍ਰੇਰਿਆ ਇਹ ਤੋਂ ਇਲਾਵਾ ਹੋਰ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਵੀ ਕੰਮ ਕੀਤੇ ਤਾਂ ਉਹਨਾਂ ਬਾਰੇ ਨਾ ਤਾਂ ਸਾਨੂੰ ਡੀਪਲੀ ਪੜ੍ਹਾਇਆ ਜਾਂਦਾ ਅਤੇ ਨਾ ਉਹਨਾਂ ਬਾਰੇ ਦੱਸਿਆ ਜਾਂਦਾ ਹੈਗਾ ਏ ਇਹ ਨਾ ਦੱਸਣ ਕਰ ਕੇ ਅਤੇ ਜਿਹੜੀ ਸਾਡੇ ਆਉਣ ਵਾਲੀ ਪੀੜ੍ਹੀ ਹੈਗੀ ਹੈ ਉਹਨਾਂ ਨੂੰ ਨਾ ਤਾਂ ਸਾਨੂੰ ਸਿੱਖ ਇਤਿਹਾਸ ਦਾ ਪਤਾ ਹੁੰਦਾ ਏ ਉਹਨਾਂ ਨੂੰ ਤਾਂ ਐਂ ਨਹੀਂ ਪਤਾ ਹੁੰਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਕਿੰਨੇ ਹੋਏ ਚਾਰ ਸਾਹਿਬਜ਼ਾਦਿਆਂ ਦੇ ਨਾਂ ਤੱਕ ਨੀ ਪਤਾ ਹੁੰਦਾ ਪੰਜਾਂ ਪਿਆਰਿਆਂ ਦੇ ਨਾਂ ਨਹੀਂ ਪਤਾ ਹੁੰਦਾ ਉਹਨੂੰ ਪੰਜ ਕਕਾਰਾਂ ਦਾ ਨਹੀਂ ਪਤਾ ਹੁੰਦਾ ਹੈਗਾ ਏ ਇਸ ਕਰਕੇ ਮਾ ਜਿਹੜੇ ਸਾਡੀ ਪੰਜਾਬ ਜਿਹੜੇ ਮਤਲਬ ਜਿਹੜੇ ਸਪੈਸ਼ਲੀ ਪੰਜਾਬ ਵਿੱਚ ਆ ਹੈਂ ਸਪੈ ਅ ਪੰਜਾਬ ਵਿੱਚ ਕਿਉਂਕਿ ਜਿਹੜੇ ਸਾਡੇ ਦਸ ਗੁਰੂ ਹੋਏ ਹੈਗੇ ਹੈ ਇਹਨਾਂ ਦਾ ਸੰਬੰਧ ਮਤਲਬ ਪੰਜਾਬ ਨਾਲ ਹੀ ਰਿਹਾ ਹੈਗਾ ਏ ਤਾਂ ਜਿਹੜੇ ਪੰਜਾਬ ਵਿੱਚ ਕੰਪਲਸਰੀ ਕਰ ਦੇਣਾ ਚਾਹੀਦਾ ਵੀ ਸਿੱਖਾਂ ਦੀਆਂ ਜਿਹੜੇ ਸਿੱਖਾਂ ਦੇ ਦਸ ਗੁਰੂ ਹੋਏ ਹੈਗੇ ਹੈ ਜਾਂ ਵੀ ਉਹਨਾਂ ਬਾਰੇ ਪ੍ਰੋਪਰ ਦੱਸਿਆ ਜਾਵੇ ਜੇ ਜੇ ਗੁਰੂਆਂ ਬਾਰੇ ਨਹੀਂ ਦੱਸਣਾ ਹੈਗਾ ਤਾਂ ਉਹਨਾਂ ਦੀ ਸਿੱਖਿਆਵਾਂ ਬਾਰੇ ਪ੍ਰੋਪਰ ਮਤਲਬ ਬੱਚਿਆਂ ਨੂੰ ਦੱਸਿਆ ਜਾਵੇ ਉਹਨਾਂ ਨੇ ਕਿਆ ਕੁਛ ਕਰਨ ਲਈ ਸਾਨੂੰ ਆਖਿਆ ਏ ਅਤੇ ਕਿੱਦਾਂ ਦਾ ਉਹਨਾਂ ਨੂੰ ਸਮਾਜ ਉਹ ਸਾਨੂੰ ਕਿੱਦਾਂ ਦੇ ਸਮਾਜ ਦੇ ਰੂਪ ਵਿੱਚ ਉਹ ਦੇਖਣਾ ਚਾਹੁੰਦੇ ਸੀਗੇ ਪੰਜਾਬ ਨੂੰ ਆਉਣ ਵਾਲ਼ੇ ਟਾਈਮ ਵਿੱਚ